ਹੈਲੋ ਵਧੀਆ ਤੂੰ ਦੱਸ ਬਸ ਕੁਛ ਨਹੀਂ ਬੈਠੀ ਸੀ ਤੂੰ ਦੱਸ ਯਾਰ ਮੈਂ ਤੈਨੂੰ ਫੋਨ ਕੀਤਾ ਸੀ ਇੱਕ ਕੰਮ ਸੀ ਉਹ ਜਿੱਦਾਂ ਹੁਣ ਮੈਂ ਤੈਨੂੰ ਪਤਾ ਹੀ ਆ ਦੂਰੋਂ ਆਉਂਦੀ ਮੇਰਾ ਕੋਲੇਜ ਦੂਰ ਆ ਅਤੇ ਮੈਨੂੰ ਨਾ ਨੇੜੇ ਕੋਈ ਪੀ ਜੀ ਜਾਂ ਕੋਈ ਹੋਸਟਲ ਚਾਹੀਦਾ ਸੀ ਅਤੇ ਮੈਂ ਬੜੇ ਦੇਖੇ ਜ ਜਿੱਥੇ ਮਤਲਬ ਮਤਲਬ ਕੁਛ ਹੈ ਵੀ ਨਹੀਂ ਉੱਥੇ ਰੇਟ ਬੜੇ ਹਾਈ ਦਿੱਤੇ ਆ ਅਤੇ ਖਾਣ ਪੀਣ ਦਾ ਸਿਸਟਮ ਵੀ ਸਹੀ ਨਹੀਂ ਹੈਗਾ ਸਫਾਈ ਸਫੁਈ ਨਹੀਂ ਹੈਗੀ ਫਿਰ ਉਹਦੇ ਕਰਕੇ ਮੈਨੂੰ ਲੱਭਦਾ ਹੀ ਨਹੀਂ ਕੁਛ ਮਤਲਬ ਸਾਰਾ ਸੀਕੁਐਂਜ਼ ਵਾਈਜ਼ ਹੈ ਨਹੀਂ ਆਂ ਹਾਂ ਹਾਂ ਸਿਰਫ ਮੈਨੂੰ ਹਾਂ ਹਾਂ ਹਾਂ ਹਾਂ ਕਿੰਨਾ ਕੁ ਦੂਰ ਹੋਣਾ ਕੋਲੇਜ ਤੋਂ ਕਿੰਨਾ ਕੁ ਦੂਰ ਹੋਣਾ ਕੋਲੇਜ ਤੋਂ ਅੱਛਾ ਤੁਰ ਕੇ ਤਾਂ ਆਈ ਜਾਈ ਸਕਦੇ ਹੈ ਨਾ ਹਾਂ ਫਿਰ ਮੇ ਮੈਨੂੰ ਵਾਹਲਾ ਔਖਾ ਹੁੰਦਾ ਨਾ ਉੱਧਰੋਂ ਆਉਣਾ ਮਤਲਬ ਪਿੰਡ ਵੱਲੋਂ ਤੈਨੂੰ ਪਤਾ ਹੀ ਆ ਰੋਜ਼ ਅਪ ਡਾਊਨ ਕਰਨਾ ਫਿਰ ਮੰਮੀ ਦੀ ਵੀ ਸਿਹਤ ਨਹੀਂ ਕਈ ਵੇਲੇ ਸਹੀ ਰਹਿੰਦੀ ਅੱਛਾ ਕਿੰਨਾ ਕੁ ਹਿਸਾਬ ਹੋਣਾ ਕਿੰਨਾ ਕੁ ਸਭ ਹੋਣਾ ਨਹੀਂ ਇੰਨਾ ਵੀ ਫਿਰ ਚੱਲ ਠੀਕ ਆ ਉੱਧਰ ਨਹੀਂ ਜਿੱਥੇ ਮੈਂ ਦੇਖੇ ਨਾ ਉੱਥੇ ਤਾਂ ਤਿੰਨ ਹਜ਼ਾਰ ਚਾਰ ਹਜ਼ਾਰ ਸਿੰਗਲ ਰੂਮ ਦਾ ਹੀ ਹਾਂ ਅਤੇ ਖਾਣਾ ਪੀਣਾ ਵੀ ਸਹੀ ਨਹੀਂ

ਹਾਂ ਤੈਨੂੰ ਜਾਣਦੇ ਵਗੈਰਾ ਉੱਦਾਂ ਜਾਣਦੇ ਵਗੈਰਾ ਤੈਨੂੰ ਅੱਛਾ ਅਤੇ ਗੱਲ ਵਗੈਰਾ ਕਰੀ ਯਾਰ ਉਹਨਾਂ ਨਾਲ ਹਾਂ ਹਾਂ

ਹਾਂ ਹਾਂ ਹਾਂ ਠੀਕ ਆ ਫਿਰ ਮੈਨੂੰ ਤਾਂ ਨੰਬਰ ਸੈਂਡ ਕਰੀ ਹਾਂ ਹਾਂ ਫਿਰ ਤੂੰ ਚੱਲ ਪੀ ਨਾਲ ਤੇਰੇ ਡੈਡੀ ਵੀ ਚੱਲ ਪਉਂਗੇ ਜੇ ਜਾਣਾ ਹੋਇਆ ਅਤੇ ਗੱਲ ਵਗੈਰਾ ਕਰ ਆਇਓ ਆਹੋ ਅਤੇ ਖਾਨਾ ਪੂਰਾ ਵੈਜ ਹੀ ਹੋਣਾ ਚਾਹੀਦਾ

ਹੋਰ ਭਰਾ ਭੈਣ ਕੀ ਕਰਦੇ ਬਸ ਪਤਾ ਹੀ ਆ ਬੀਕੋਮ ਕਰਦੀ ਡੀ ਏ ਵੀ ਇੱਧਰ ਵਾਹਲਾ ਦੂਰ ਹੋ ਜਾਂਦਾ ਪਿੰਡ ਤੋਂ ਫਿਰ ਤੂੰ ਹਾਂ ਫਿਰ ਤਦੇ ਤਾਂ ਮੈਂ ਪੀ ਜੀ ਹੋਸਟਲ ਦਾ ਦੇਖਦੀ ਵੀ ਕੋਈ ਮਿਲਦੇ ਹੀ ਨਹੀਂ ਹੈਗੇ ਮਿਲਦੀ ਆ ਤਾਂ ਫਿਰ ਕੋਈ ਵਧੀਆ ਨਹੀਂ ਹੈਗੀ ਸਵੇਰੇ ਛੇ ਵਜੇ ਦੀ ਬੱਸ ਫੜ੍ਹਦੀ ਇੱਧਰੋਂ ਪਿੰਡੋਂ ਹੋਰ ਹੋਰ ਫਿਰ ਕਈ ਵੇਲੇ ਮੰਮੀ ਦੀ ਸਿਹਤ ਨਹੀਂ ਸਹੀ ਹੁੰਦੀ ਰੋਟੀ ਪਾਣੀ ਵੀ ਬਣਾਉਣਾ ਹੁੰਦਾ ਰਾਤ ਦਾ ਅਤੇ ਉਹ ਉਪਰੋਂ ਆਪਣਾ ਪੜ੍ਹੋ ਵੀ ਉਹ ਵੀ ਵੱਖਰਾ

ਹਾਂ ਪਤਾ ਕਰੀ ਨਹੀਂ ਮੈਂ ਤਦੇ ਹੀ ਲੱਭਦੀ ਸੀਗੀ ਵੀ ਆਹ ਨੇੜੇ ਹੋ ਜੂੰਗਾ ਨਾ ਉੱਧਰੋਂ ਹਾਂ ਨਾਲੇ ਬੱਸਾਂ ਦਾ ਕਿਰਾਇਆ ਉਹ ਵੱਖਰਾ ਮੈਂ ਤਾਂ ਕੋਲ ਕੋਲੇਜ ਦੇ ਨੇੜੇ ਜੇ ਕੋਈ ਮਿਲ ਜਾਵੇ ਫਿਰ ਪੈਦਲ ਵੀ ਬੰਦਾ ਆ ਜਾ ਸਕਦਾ ਆ

ਹਾਂ ਅਤੇ ਨਾਲੇ ਮਤਲਬ ਵਧੀਆ ਜਿਹੇ 'ਚ ਹੋਵੇ ਮਤਲਬ ਇੱਦਾਂ ਨਾ ਹੋਵੇ ਵਾਹਲੇ ਮੁੰਡੇ ਵਗੈਰਾ ਹੋਣ ਉੱਧਰ ਅੱਛਾ ਹੋਰ ਭਰਾ ਭੈਣ ਵਗੈਰਾ ਸਹੀ ਸਾਰੇ ਹਾਂ ਬਸ ਸਹੀ ਆ ਮੰਮਾ ਇੱਦਾਂ ਦਾ ਕੁਛ ਨਹੀਂ ਬਸ ਚੱਲ ਠੀਕ ਆ ਫਿਰ ਮੰਮਾ ਸੱਦ ਦੇ ਸੀਗੇ ਓਕੇ ਚੰਗਾ